ਪੰਜਾਬ ਦੇ ਵਿੱਚ ਜਾਂ ਪੰਜਾਬ ਰਾਜ ਦੇ ਵਿੱਚ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਇੱਕ ਕ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਂਦਾ ਸਕੂਲਾਂ ਦੇ ਵਿੱਚ ਵੀ ਅਤੇ ਕਾਲਜਾਂ ਦੇ ਵਿੱਚ ਵੀ ਸਿੱਖਿਆ ਦਾ ਮਾਧਿਅਮ ਮੰਨੀ ਜਾਂਦੀ ਹੈ ਪਰ ਸਰਕਾਰੀ ਸਕੂਲਾਂ ਦੇ ਵਿੱਚ ਬਿਨਾਂ ਸ਼ੱਕ ਪਹਿਲੀ ਕਲਾਸ ਤੋਂ ਹੀ ਬੱਚਿਆਂ ਨੂੰ ਪੰਜਾਬੀ ਦੇ ਵਿੱਚ ਜਿਹੜੀ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਪਰ ਉਸ ਦੇ ਉਲਟ ਜੇ ਵੇਖਿਆ ਜਾਵੇ ਤਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਤੀਜੀ ਪੰਜਵੀਂ ਜਾਂ ਛੇਵੀਂ ਦੇ ਵਿੱਚ ਜਿਹੜੀ ਹੈ ਪੰਜਾਬੀ ਪੜ੍ਹਾਈ ਜਾਂਦੀ ਹੈ ਅਤੇ ਅੰਗਰੇਜ਼ੀ ਦੇ ਵਿੱਚ ਹੀ ਬਾਕੀ ਵਿਸ਼ੇ ਜਿਹੜੇ ਨੇ ਪੜ੍ਹਾਏ ਜਾਂਦੇ ਨੇੇ ਜਿਸ ਕਾਰਨ ਬੱਚਿਆਂ ਦਾ ਪੰਜਾਬੀ ਦੇ ਵਿੱਚ ਕੋਈ ਵੀ ਜਿਹੜੀ ਹੈ ਰੁਚੀ ਜਾਂ ਦਿਲਚਸਪੀ ਨਹੀਂ ਬਣਦੀ ਪੰਜਾਬੀ ਨੂੰ ਉਹ ਮਜ਼ਬੂਰੀ ਵਜੋਂ ਪੜ੍ਹਦੇ ਨੇ ਕਿਉਂਕਿ ਉਹਨਾਂ ਨੂੰ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ 'ਤੇ ਵੀ ਪਾਬੰਦੀ ਲਗਾਈ ਜਾਂਦੀ ਹੈ ਇਥੋਂ ਤੱਕ ਕਿ ਜਦੋਂ ਪੇਰੈਂਟਸ ਮੀਟਿੰਗ ਦੇ ਵਿੱਚ ਜਾਂਦੇ ਨੇ ਪੇਰੈਂਟਸ ਉਹਨਾਂ ਨੂੰ ਕਿਹਾ ਜਾਂਦਾ ਬੱਚਿਆਂ ਦੇ ਨਾਲ ਘਰਾਂ ਦੇ ਵਿੱਚ ਅੰਗਰੇਜ਼ੀ ਬੋਲਿਆ ਕਰੋ ਤਾਂ ਸਕੂਲ ਜਿਹੜੇ ਮੁੱਖ ਤੌਰ 'ਤੇ ਮਤਲਬ ਹਰ ਬੱਚੇ ਦੇ ਲਈ ਮੁੱਢਲੀ ਸਿੱਖਿਆ ਦਿੰਦੇ ਨੇ ਉੱਥੇ ਹੀ ਪੰਜਾਬੀ ਦਾ ਕੋਈ ਬਹੁਤਾ ਚੰਗਾ ਰੁਝਾਨ ਜਿਹੜਾ ਉਹ ਨਹੀਂ ਹੈਗਾ ਮੈਂ ਵੀ ਪੰਜਾਬੀ ਦੀ ਇੱਕ ਅਧਿਆਪਕ ਹਾਂ ਅਸੀਂ ਵੇਖਦੇ ਹਾਂ ਇੱਥੇ ਕਿ ਬੱਚੇ ਜਿਹੜੇ ਨੇ ਉਹ ਬਿਨਾਂ ਸ਼ੱਕ ਪੰਜਾਬੀ ਬਹੁਤ ਚੰਗੇ ਤਰੀਕੇ ਨਾਲ ਬੋਲਣਾ ਸਿੱਖ ਜਾਂਦੇ ਨੇ ਪਰ ਕੁਝ ਅਜਿਹੇ ਸ਼ਬਦ ਹੁੰਦੇ ਨੇ ਜਿਵੇਂ ਅਸੀਂ ਟੀਪੀਕਲ ਸ਼ਬਦ ਬੋਲਦੇ ਹਾਂ ਉਹ ਪੰਜਾਬੀ ਭਾਸ਼ਾ ਦੇ ਹੀ ਹਨ ਪਰ ਬੱਚਿਆਂ ਨੂੰ ਉਹਨਾਂ ਦੇ ਅਰਥ ਵੀ ਪਤਾ ਨਹੀਂ ਹੁੰਦੇ ਕਿਉਂਕਿ ਉਹ ਸਿਰਫ ਘਰਾਂ ਦੇ ਵਿੱਚ ਹੀ ਪੰਜਾਬੀ ਬੋਲਦੇ ਜਾਂ ਸੁਣਦੇ ਨੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਉਹ ਹਿੰਦੀ ਜਾਂ ਅੰਗਰੇਜ਼ੀ ਦੇ ਵਿੱਚ ਗੱਲ ਕਰਦੇ ਨੇ ਅਤੇ ਇਸ ਤਰ੍ਹਾਂ ਪੰਜਾਬ ਸੂਬੇ ਦੀ ਜਿਹੜੀ ਰਾਜ ਭਾਸ਼ਾ ਹੈ ਪੰਜਾਬੀ ਹੈ ਅਤੇ ਅੱਜ ਦੇ ਸਮੇਂ ਦੇ ਵਿੱਚ ਜੇ ਵੇਖਿਆ ਜਾਵੇ ਤਾਂ ਸਿੱਖਿਆ ਦੇ ਵਿੱਚੋਂ ਉਹਦੀ ਕੋਈ ਬਹੁਤੀ ਵਧੀਆ ਭੂਮਿਕਾ ਨਹੀਂ ਰਹੀ ਕਿਉਂਕਿ ਬਥੇਰੇ ਮਾਤਾ ਪਿਤਾ ਨੇ ਜਿਹੜੇ ਉਹ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੀ ਬਜਾਏ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਨੇ ਇਸ ਕਰਕੇ ਸਿੱਖਿਆ ਦੇ ਵਿੱਚ ਜਿਹੜੀ ਪੰਜਾਬੀ ਹੈ ਉਹਦਾ ਜਿਹੜਾ ਰੁ ਰੁ ਰੁਝਾਨ ਹੈ ਜਾਂ ਰੁਚੀ ਹੈ ਉਹ ਥੋੜ੍ਹੀ ਘਟਦੀ ਜਾ ਰਹੀ ਹੈ ਇਹਦਾ ਇੱਕ ਕਾਰਨ ਇਹ ਵੀ ਹੈ ਕਿ ਪੰਜਾਬ ਰਾਜ ਦੇ ਵਿੱਚੋਂ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਵਿਦੇਸ਼ ਜਾ ਚੁੱਕੇ ਨੇ ਅਤੇ ਜਾਣ ਦੇ ਇਛੁੱਕ ਨੇ ਅਤੇ ਉਹਨਾਂ ਨੂੰ ਲੱਗਦਾ ਇੰਟਰਨੈਸ਼ਨਲ ਜਿਹੜੀ ਭਾਸ਼ਾ ਹੈ ਅੰਗਰੇਜੀ ਉਹਦਾ ਆਉਣਾ ਜ਼ਰੂਰੀ ਹੈ